ਮੈਂ ਆਪਣੀ ਜ਼ਿੰਦਗੀ ਵਿੱਚ ਆਪਣੇ ਮਾਂ ਪਿਓ ਦੀ ਬਹੁਤ ਜ਼ਿਆਦਾ ਕਦਰ ਕਰਦਾ ਏ ਕਿਉਂਕਿ ਉਹਨਾਂ ਨੇ ਸਾਨੂੰ ਪੜ੍ਹਾਇਆ ਲਿਖਾਇਆ ਕਾਬਲ ਬਣਾਇਆ ਇਸ ਲਈ ਮੈਂ ਉਹਨਾਂ ਦੀ ਬਹੁਤ ਕਦਰ ਕਰਦਾ ਏ ਪ੍ਰਮਾਤਮਾ ਉਹਨਾਂ ਨੂੰ ਬਹੁਤ ਜ਼ਿਆਦਾ ਤੰਦਰੁਸਤ ਰੱਖੇ ਉਹਨਾਂ ਨੂੰ ਖੁਸ਼ ਰੱਖੇ ਉਹਨਾਂ ਨੂੰ ਸਿਹਤਯਾਬ ਰੱਖੇ ਅਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਬਖ਼ਸ਼ੇ ਧੰਨਵਾਦ